ਹੈਲੋ ਸਤਿ ਸ਼੍ਰੀ ਅਕਾਲ ਮੈਮ ਜੀ ਮੈਮ ਮੈਂ ਨਾ ਅ ਬਠਿੰਡੇ ਲੋ ਮਤਲਬ ਕਿ ਟੂਰਿਸਟ ਵਜੋਂ ਆਇਆ ਹੋਇਆ ਮੈਨੂੰ ਇੱਥੇ ਕੋਈ ਘੁੰਮਣ ਲਈ ਕਿਹੜੀਆਂ ਕਿਹੜੀਆਂ ਵਧੀਆ ਜਗ੍ਹਾ ਹੈਗੀਆਂ ਉਨ੍ਹਾਂ ਬਾਰੇ ਦੱਸੋਗੇ

ਹਾਂਜੀ ਉੱਥੇ ਮੈਮ ਜਾਣ ਲਈ ਉੱਥੇ ਜਾਣ ਲਈ ਮੈਮ ਮਤਲਬ ਕਿਹੜੇ ਅ ਵਹੀਕਲ ਦੀ ਯੂਜ਼ ਕਰ ਸਕਦੇ ਅੱਛਾ ਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਉੱਥੇ ਜਾਣ ਲਈ ਮੈਮ ਮਤਲਬ ਕਿਹੜੇ ਵਹੀਕਲ ਦਾ ਯ ਅ ਕਰ ਸਕਦੇ ਆਪਾਂ ਉਹਦੇ ਓ ਕੋਈ ਹੈ ਜਾਣ ਲਈ ਉੱਥੇ ਸਾਧਨ ਹਾਂਜੀ

ਇਹ ਝੀਲਾਂ ਕੋਲ ਹੈ ਜੀ ਅੱਛਾ ਜੀ ਉੱਥੋਂ ਕਿਹੜੀ ਕਿਹੜੀ ਸਾਈਡ ਨੂੰ ਰਹਿ ਜਾਂਦਾ ਜੀ ਅੱਛਾ ਜੀ ਤੇ ਅੱਛਾ ਜੀ ਹਾਂਜੀ